ਹੈਲੋ ਔਰ ਬਾਊ ਜੀ ਕੀ ਹਾਲ ਹੈ ਅੱਛਾ ਜੀ ਅੱਛਾ ਅੱਛਾ ਸਰ ਕਦੋਂ ਕਦੋਂ ਕੁ ਲੈ ਕੇ ਗਏ ਹੋ ਤੁਸੀਂ ਕਿੰਨੇ ਕਿੰਨੇ ਕੁ ਦਿਨ ਹੋ ਗਏ ਚਲੋ ਮੈਂ ਚੈੱਕ ਕਰਾਂ ਓਹ ਮੁੰਡਾ ਹੋਣਾ ਦੁਕਾਨ 'ਤੇ ਮੈਂ ਇਹ ਤਾਂ ਹੈ ਨਹੀਂ ਸੀ ਤੁਹਾਨੂੰ ਪਤਾ ਕੋਈ ਨਹੀਂ ਮੈਂ ਪਤਾ ਕਰਦਾ ਕਿਹੜਾ ਉਹ ਕੁਆਲਿਟੀ ਦਾ ਉਹਨੇ ਵਰਤਿਆ ਗਿਆ ਕਰਦੇ ਹਾਂ ਅੱਛਾ ਜੀ ਮੈਂ ਪੂਰਾ ਹੁਣ ਧਿਆਨ ਰ ਰੱਖਣਾ ਜੀ ਅੱਗੇ ਤੋਂ ਨਾ ਉਹਨੂੰ ਸਿਖਾ ਕੇ ਰੱਖਾਂਗਾ ਮੁੰਡੇ ਨੂੰ ਵੀ ਸਹੀ ਤਰ੍ਹਾਂ ਹਾਈਜੀਨਿਕ ਤਰੀਕੇ ਨਾਲ ਇੱਕ ਤਾਂ ਸਹੀ ਰੈਸਪੀ ਨਾਲ ਕਈ ਵਾਰੀ ਉਹ ਹੁੰਦਾ ਸੀ ਤੇਲ ਵੱਧ ਘੱਟ ਪਾ ਦਿੰਦੇ ਨੇ ਜਾਂ ਕਿਵੇਂ ਕਈ ਵਾਰੀ ਹੱਥ ਵੀ ਹੁੰਦੇ ਨੇ ਕਈ ਵਾਰੀ ਨਹੀਂ ਧੋਤੇ ਹੁੰਦੇ ਮੁੰਡਿਆਂ ਨੂੰ ਦੱਸਣਾ ਪੈਂਦਾ ਜੀ ਤਾਂ ਸੋਰੀ ਇਹ ਮੇਰੀ ਇੰਨਕਨੀਵੀਨੀਅੰਸ ਦੇ ਕਰਕੇ ਮਤਲਬ ਇਹਨੂੰ ਮਤਲਬ ਟਰੇਨਡ ਕਰਨਾ ਹਾਲੇ ਮੈਂ ਮੁੰਡੇ ਨੂੰ ਅਤੇ ਅੱਗੇ ਤੋਂ ਧਿਆਨ ਰੱਖਾਂਗੇ ਸਾਰੀ ਹਾਈਜੀਨ ਦਾ ਅੱਛਾ ਹੁਣ ਤਾਂ ਬਾਊ ਜੀ ਅਸੀਂ ਕਰਦੇ ਹਾਂ ਤਾਜ਼ਾ ਆਲੂ ਵਰਤਿਆ ਕਰਾਂਗੇ ਵੈਸੇ ਅੱਗੇ ਵੀ ਤਾਜ਼ੇ ਹੀ ਵਰਤਦੇ ਹਾਂ ਪਰ ਮਤਲਬ ਹੁਣ ਸਵੇਰੇ ਸਵੇਰੇ ਮੰਡੀ ਜਾ ਕੇ ਜਿਵੇਂ ਲੈ ਆਇਆ ਕਰਾਂਗਾ ਨਾ ਹੋਰ ਕੋਈ ਨਹੀਂ ਪੂਰਾ ਧਿਆਨ ਰੱਖਿਆ ਕਰਾਂਗੇ ਹੈਂ ਹਾਈਜੀਨ ਉਹਨੂੰ ਸੋਰੀ ਬਾਊ ਜੀ ਕਈ ਤਾਂ ਨਾ ਵੀ ਸਿਖਾ ਦਾ ਉਹਨਾਂ ਨੂੰ ਮੁੰਡੇ ਨੂੰ ਪੂਰਾ ਟ੍ਰੇਨਡ ਕਰਨਾ ਉਹ ਨਵਾਂ ਨਵਾਂ ਲੱਗਿਆ ਵਿਚਾਰਾਂ ਉਹ ਨੂੰ ਪਤਾ ਪੁਤਾ ਕੁਛ ਹੈ ਨਹੀਂ ਉਹਨੂੰ ਚੰਗੀ ਤਰ੍ਹਾਂ ਸਿਖਾਵਾਂਗੇ ਨਹੀਂ ਨਹੀਂ ਹੁਣ ਸਰ ਆਪਾਂ ਪੂਰੀ ਹਾਈਜੀਨ ਦਾ ਪੂਰਾ ਧਿਆਨ ਰੱਖਣਾ ਸਿਖਾ ਦੇਣਾ ਵੀ ਕੀ ਕਹਿੰਦੇ ਹਾਂ ਜਦੋਂ ਕੋਈ ਚੀਜ਼ ਬਣਾਉਣੀ ਜਾਂ ਸਰਵ ਕਰਨੀ ਗਲਬਸ ਹੱਥਾਂ 'ਚ ਪਾ ਕੇ ਚੰਗੀ ਤਰ੍ਹਾਂ ਮਤਲਬ ਹਾਈਜੀਨ ਸਾਫ ਸਫਾਈ ਰੱਖ ਕੇ ਸਲੈਪ 'ਤੇ ਕੱਪੜਾ ਮਾਰ ਕੇ ਅਗਲੇ ਨੇ ਬਣਾਉਣਾ ਜੋ ਬਣਾਉਣਾ ਆਪਾਂ ਹੁਣ ਚੰਗੀ ਤਰ੍ਹਾਂ ਟ੍ਰੇਨਡ ਕਰ ਦੇਣਾ ਹੈ ਅਤੇ ਇਨਕਨਵੀਨੀਅੰਸ ਵਾਸਤੇ ਥੋੜ੍ਹੀ ਜਿਹੀ ਸੋਰੀ ਮੰਗਦਾ ਅਸੁਵਿਧਾ ਵਾਸਤੇ ਅੱਛਾ ਅੱਛਾ ਕੋਈ ਨਹੀਂ ਸਰ ਹੁਣ ਤਾਂ ਪੂਰਾ ਮਤਲਬ ਧਿਆਨ ਰੱਖਣਾ ਤੁਸੀਂ ਪਹਿਲਾਂ ਹੀ ਦੱਸ ਦਿੰਦੇ ਉਦੋਂ ਚਲੋ ਕੋਈ ਨਹੀਂ ਤੁਸੀਂ ਪਹਿਲਾਂ ਨਹੀਂ ਦੱਸਿਆ ਕਰੋਨਾ ਤੋਂ ਪੂਰਾ ਧਿਆਨ ਰੱਖਾਂਗੇ ਐਵੇਂ ਪਤਾ ਕੀ ਤੁਹਾਡੇ ਨਾਲ ਹੋਰ ਕਸਟਮਰ ਵੀ ਸਾਡੇ ਖਰਾਬ ਹੁੰਦੇ ਨੇ ਇਹ ਚੰਗੀ ਗੱਲ ਹੈ ਤੁਸੀਂ ਸ਼ਿਕਾਇਤ ਕਰਤੀ ਹੁਣ ਅਸੀਂ ਇੰਪਰੂਵਮੈਂਟ 'ਤੇ ਧਿਆਨ ਦਵਾਂਗੇ ਥੋੜ੍ਹਾ ਜਿਹਾ ਚਲੋ ਸਰ ਓ ਓਕੇ ਸਰ ਥੈਂਕ ਯੂ ਹੈਂ